ਜਦ ਇਹ ਔਡਰ ਤਿਆਰ ਹੋ ਜਾਵੇਗਾ ਤੁਸੀਂ ਆਪਣੇ ਡਿਲੀਵਰੀ ਬੋਆਏ ਨੂੰ ਭੇਜ ਦਿਓ ਅਤੇ ਮੈਂ ਤੁਹਾਨੂੰ ਪੇਮੈਂਟ ਬਾਰੇ ਗੱਲ ਕਰਨੀ ਸੀ ਕਿ ਤੁਸੀਂ ਗੂਗਲ ਪੇ ਦੇ ਰਾਹੀਂ ਪੇਮੈਂਟ ਪ੍ਰਾਪਤ ਕਰ ਲੈਂਦੇ ਹੋ ਜੇ ਕਰ ਲੈਂਦੇ ਹੋ ਤਾਂ ਪਲੀਜ਼ ਆਪਣਾ ਕਿਊ ਆਰ ਕੋਡ ਆਪਣੇ ਡਿਲੀਵਰੀ ਬੋਆਏ ਦੇ ਨਾਲ ਭੇਜ ਦਿਓ ਮੇਰੇ ਕੋਲ ਇਸ ਟਾਈਮ ਕੈਸ਼ ਐਵਲੀਏਬਲ ਨਹੀਂ ਹੈ ਸੋ ਤੁਸੀਂ ਆਪਣਾ ਕਿਊ ਆਰ ਕੋਡ ਭੇਜ ਦਿਓ ਧੰਨਵਾਦ